ਮੈਂ ਸਿੱਖ ਧਰਮ ਨਾਲ ਸੰਬੰਧ ਰੱਖਦਾ ਹਾਂ ਸਾਡੇ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਵੀ ਗ੍ਰੰਥ ਸਾਹਿਬ ਨਹੀਂ ਹੈ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਸਾਨੂੰ ਸਾਂਝੀਵਾਲਤਾ ਦਾ ਦੇ ਬਾਰੇ ਸਿਖਾਉਂਦੇ ਹਨ ਜੇ ਅਸੀਂ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਜਾਈਏ ਤਾਂ ਸਾਨੂੰ ਉੱਥੇ ਚਾਰ ਦਰਵਾਜ਼ੇ ਮਿਲਦੇ ਹਨ ਜੋ ਕੇ ਸਾਨੂੰ ਕਿਸੇ ਵੀ ਭੇਦ ਭਾਵ ਜਾਤ ਪਾਤ ਜਾਂ ਚਾਰੋਂ ਦਿਸ਼ਾ ਤੋਂ ਆਉਣ ਵਾਲਿਆਂ ਬਾਰੇ ਸਾਨੂੰ ਬਿਲਕੁਲ ਜਾਗਰੂਕ ਕਰਦੇ ਹਨ ਔਰ ਸਹੀ ਸ਼ਿਖਸਾ ਦਿੰਦੇ ਹਨ ਔਰ ਸਾਡੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਚੌਵੀ ਘੰਟੇ ਲੰਗਰ ਚੱਲਦਾ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਇਆ ਗਿਆ ਸੀ ਹੁਣ ਤੱਕ ਚੱਲਦਾ ਹੈ ਔਰ ਅੱਗੇ ਵੀ ਚੱਲੇਗਾ ਔਰ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਸਾਡਾ ਜੋ ਨਿਸ਼ਾਨ ਹੈ ਸਾਡਾ ਖੰਡਾ ਜੋ ਕਿ ਸਾਨੂੰ ਦੂਰੋਂ ਗੁਰਦੁਆ ਬਹੁਤ ਜ਼ਿਆਦਾ ਉੱਚੀ ਹਾਈਟ ਦੇ ਉੱਪਰ ਲਗਾਇਆ ਜਾਂਦਾ ਹੈ ਇੱਕ ਪੀਲੇ ਰੰਗ ਦੇ ਵਿੱਚ ਔਰ ਇੱਕ ਨੀਲੇ ਰੰਗ ਦੇ ਵਿੱਚ ਜੋ ਕਿ ਸਾਡਾ ਇਹ ਨਿਸ਼ਾਨ ਹੈ ਦੂਰੋਂ ਦੇਖ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਗੁਰਦੁਆਰਾ ਸਾਹਿਬ ਹੈ